ਹੈਲੋ ਪੈਰੀਂ ਪੈਂਦਾ ਮੈਨੇਜਰ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਅੱਛਾ ਅੱਛਾ ਸਰ ਘਰੇਲੂ ਕੋਈ ਘਰੇਲੂ ਪ੍ਰੋਬਲਮ ਹੈ ਸਰ ਸਰ ਮੈਂ ਪੂਰਾ ਕਰ ਦੇਵਾਂਗਾ ਓਵਰ ਟਾਈਮ ਲਾ ਲਾ ਕੇ ਚੱਲੋ ਸਰ ਨਾਲੇ ਮੈਨੂੰ ਪਤਾ ਤਬੀਅਤ ਤਬੀਅਤ ਵੀ ਨਹੀਂ ਤਬੀਅਤ ਵੀ ਨਹੀਂ ਠੀਕ ਰਹਿੰਦੀ ਸਰ ਕੰਮ ਜ਼ਿਆਦਾ ਹੋ ਨਹੀਂ ਪਾਉਂਦਾ ਫਿਰ ਵੀ ਮੈਂ ਕਰਦਾ ਨਹੀਂ ਸਰ ਮੈਂ ਹੈਗਾ ਮੈਂ ਕਰ ਲਵਾਂਗਾ ਸਰ ਕੋਈ ਨਾ ਸਰ ਉਹ ਕਰਕੇ ਦੇਵਾਂਗਾ ਤੁਹਾਨੂੰ ਪੂਰਾ ਨਾ ਜਨਾਬ ਸੈਲਰੀਆਂ ਕੱਟ ਕੇ ਗਰੀਬ ਬੰਦਾ ਯਾਰ ਭੁੱਖਾ ਮਰਦੇ ਪਏ ਹਾਂ ਅੱਗੇ ਖਾਣ ਨੂੰ ਖਾਣਾ ਨਹੀਂ ਮਿਲ ਰਿਹਾ ਸਰ ਅੱਗੇ ਪੰਜ ਅੱਗੇ ਪੰਜ ਹਜ਼ਾਰ ਸੈਲਰੀ ਹੈ ਸਰ ਹੋਰ ਕਿੰਨੀ ਕੱਟ ਸਕਦੇ ਹੈ ਸਰ ਅੱਗੇ ਮਸਾਂ ਗੁਜ਼ਾਰਾ ਹੁੰਦਾ ਸਰ ਸਰ ਮੈਂ ਕੰਮ ਪੂਰਾ ਕਰਾਂਗਾ ਸਰ ਟੈਂਸ਼ਨ ਨਾ ਲਿਓ ਤੁਸੀਂ ਸਰ ਸਾਰਾ ਕੰਮ ਕਰਾਂਗਾ ਔਰ ਕੀ ਆ ਗਈ ਸਰ ਸਰ ਮੈਂ ਸਰ ਮੈਂ ਦੂਰੋਂ ਆਉਂਦਾ ਸਰ ਮੈਂ ਸਾਈਕਲ 'ਤੇ ਆਉਂਦਾ ਹੁੰਦਾ ਘਰ ਵੀ ਬੱਚਿਆਂ ਨੂੰ ਸਕੂਲ ਛੱਡ ਕੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਹੁੰਦਾ ਹਾਂਜੀ ਸਰ

ਠੀਕ ਠੀਕ ਹੈ ਮਿਹਰਬਾਨੀ ਮਹਾਰਾਜ ਬਹੁਤ ਬਹੁਤ ਮਿਹਰਬਾਨੀ ਮਹਾਰਾਜ ਧੰਨਵਾਦ ਤੁਹਾਡਾ ਸਰ ਮੈਂ ਮੰਨਦਾ ਗਾ ਤੁਹਾਡੀ ਸਰ ਅੱਗੇ ਤੋਂ ਸਰ ਤੁਸੀਂ ਵੇਖੋ ਮੇਰੇ ਤੋਂ ਕੋਈ ਕੰਪਲੇਂਟ ਨਹੀਂ ਆਵੇਗੀ ਸਰ ਮੇਰੇ ਖਿਲਾਫ਼ ਹਾਂਜੀ ਮੈਂ ਸਰ ਪੂਰੇ ਟਾਈਮ 'ਤੇ ਪਹੁੰਚਾਂਗਾ ਨਾਲੇ ਕੋਈ ਕੰਪਲੇਂਟ ਨਹੀਂ ਆਵੇਗੀ ਨਾਲੇ ਨਾਲੇ ਸਰ ਮੈਂ ਬਹੁਤ ਪੁਰਾਣਾ ਐਂਪਲਾਈ ਹਾਂ ਤੁਹਾਡਾ ਬਹੁਤ ਮੇਰਾ ਕਦੇ ਕੰਪਲੇਂਟ ਨਹੀਂ ਆਈ ਹਾਂਜੀ ਲਿਹਾਜ਼ ਕਰੋ ਸਰ ਥੋੜ੍ਹਾ ਠੀਕ ਹੈ ਸਰ ਓਕੇ ਸਰ ਅਗਾਂਹ ਤੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਵੇਗੀ ਸ਼ਿਕਾਇਤ ਦਾ ਮੌਕਾ ਹੀ ਨਹੀਂ ਦੇਣਾ ਸਰ ਪੂਰਾ ਕੰਮ ਕਰਾਂਗੇ ਟਾਈਮ 'ਤੇ ਆ ਜਾਂਗੇ ਕੱਲ੍ਹ ਯੈੱਸ ਸਰ ਹਾਂਜੀ ਸਰ ਓਕੇ ਸਰ ਧੰਨਵਾਦ ਠੀਕ ਹੈ ਸਰ ਬਹੁਤ ਬਹੁਤ ਮਿਹਰਬਾਨੀ ਮਹਾਰਾਜ ਧੰਨਵਾਦ ਤੁਸੀਂ ਸਾਡੀ ਸੁਣ ਲਈ